ਅਪ ਆਪਣਾ ਜਦੋਂ ਅਸੀਂ ਖੁੱਲ੍ਹੇ ਪਾਣੀ ਦੇ ਵਿੱਚ ਤੈਰਦੇ ਹਾਂ ਤਾਂ ਖੁੱਲੇ ਪਾਣੀ ਦੇ ਵਿੱਚ ਤੈਰਦੇ ਸਮੇਂ ਸਾਨੂੰ ਆਪਣਾ ਬਚਾਅ ਰੱਖਣਾ ਚਾਹੀਦਾ ਹੈ ਕਿਉਂਕਿ ਪਾਣੀ ਦਾ ਸਤਰ ਕਿਸ ਜਗ੍ਹਾ 'ਤੇ ਡੂੰਘਾ ਹੈ ਆਪਣੇ ਕਿਸ ਅਸਥਾਨ 'ਤੇ ਉੱਚਾ ਹੈ ਕਿਉਂਕਿ ਤੈਰਦੇ ਸਮੇਂ ਆਪਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਇਹ ਚਾਹੀਦਾ ਹੈ ਕਿ ਪਾਣੀ ਦੀ ਜ਼ਿਆਦੇ ਮਕੀ ਪਾਣੀ ਦੇ ਅੰਦਰ ਜ਼ਿਆਦਾ ਆਪਣਾ ਤਿਲਕਣ ਨਾ ਹੋ ਹੋਵੇ ਕਿਉਂਕਿ ਜਿਸ ਪਾਣੀ ਦੇ ਅੰਦਰ ਜ਼ਿਆਦਾ ਤਿਲਕਣ ਹੋਏਗੀ ਜਾਂ ਪਾਣੀ ਖਰਾਬ ਹੋਏਗਾ ਉਹ ਸਾਡੀ ਸਿਹਤ ਲਈ ਵੀ ਖਰਾਬ ਆਪਣਾ ਕਰੇਗਾ ਜਿਹੜੀ ਤਿਲਕਣ ਏ ਤਿਲਕਣ ਦੇ ਸਮੇਂ ਵੀ ਸਾਨੂੰ ਸਾਵਧਾਨੀਆਂ ਰੱਖਣੀਆਂ ਵੀ ਚਾਹੀਦੀਆਂ ਹਨ ਕਿਉਂਕਿ ਜੇ ਅਸੀਂ ਕਿਤੇ ਸਮੁੰਦਰ ਵਿੱਚ ਜਾਂ ਸੂਏ ਵਿੱਚ ਨਹਾਉਂਦੇ ਹਾਂ ਤਾਂ ਨਹਾਉਂਦੇ ਸਮੇਂ ਸਾਨੂੰ ਖਿਆਲ ਰੱਖਣਾ ਹੀ ਚਾਹੀਦਾ ਹੈ ਕਿ ਅਸੀਂ ਨ ਨਹਾਉਣ ਸਮੇਂ ਜ਼ਿਆਦੇ ਡੂੰਘੇ ਪਾਣੀ ਵਿੱਚ ਨਾ ਜਾ ਜਾਈਏ ਕਿਉਂਕਿ ਡੂੰਘੇ ਪਾਣੀ ਦੇ ਵਿੱਚ ਜਾਣ ਨਾਲ ਸਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ ਕਿਉਂਕਿ ਉਹਦੇ ਵਿੱਚ ਸਾਨੂੰ ਆਪਣਾ ਡੁੱਬਣ ਦਾ ਵੀ ਖਤਰਾ ਹੋ ਸਕਦਾ ਹੈ ਅਤੇ ਨਾ ਨਹਾਉਣਾ ਮੈਨੂੰ ਪਾਣੀ ਦੇ ਵਿੱਚ ਤੈਰਨਾ ਪਸੰਦ ਹੈ ਕਿਉਂਕਿ ਮੈਂ ਉਸ ਜ ਜਗ੍ਹਾ 'ਤੇ ਹੀ ਤੈਰਨਾ ਪਸੰਦ ਕਰਦਾ ਹਾਂ ਜਿੱਥੇ ਪਾਣੀ ਸਾਫ ਹੈ ਪਾਣੀ ਉੱਚਾ ਹੈ